ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਮੁੱਖ ਤੌਰ 'ਤੇ ਪਾਠਕ੍ਰਮ ਅਤੇ ਸਿੱਖਣ ਦੇ ਮਾਪਦੰਡਾਂ ਦੇ ਹਿਸਾਬ ਨਾਲ ਬਹੁਤ ਹੀ ਸੰਗਠਿਤ ਹੈ ਇਹ ਪਾਠਕ੍ਰਮ ਮੁੱਖ ਤੌਰ 'ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਤਿਆਰ ਕੀਤਾ ਜਾਂਦਾ ਹੈ ਪ੍ਰਾਈਮਰੀ ਸਿਖਲਾਈ ਤੋਂ ਲੈ ਕੇ ਸਕੈਂਡਰੀਜ ਅਤੇ ਸੀਨੀਅਰ ਸੈਕੈਂਡਰੀ ਤੱਕ ਵਿਦਿਆਰਥੀਆਂ ਨੂੰ ਵਿਭਿੰਨ ਵਿਸ਼ਿਆਂ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ ਜਿਵੇਂ ਕਿ ਗਣਿਤ ਵਿਗਿਆਨ ਸਮਾਜਿਕ ਵਿਗਿਆਨ ਭਾਸ਼ਾ ਅਤੇ ਕੰਪਿਊਟਰ ਸਿੱਖਿਆ ਪ੍ਰਾਇਮਰੀ ਪੱਧਰ 'ਤੇ ਮੁੱਖ ਧਿਆਨ ਬੁਨਿਆਦੀ ਪੜ੍ਹਨ ਲਿਖਣ ਅਤੇ ਗਿਣਤੀ ਦੀਆਂ ਯੋਗਤਾਵਾਂ 'ਤੇ ਹੁੰਦਾ ਹੈ ਸਕੈਂਡਰੀ ਪੱਧਰ 'ਤੇ ਵਿਸ਼ੇਸ਼ ਦੀ ਚੋਣ ਦਾ ਮੌਕਾ ਹੁੰਦਾ ਹੈ ਜਿਸ ਵਿੱਚ ਕਲਾ ਵਪਾਰ ਅਤੇ ਵਿਗਿਆਨ ਸ਼ਾਮਿਲ ਹਨ ਸਿੱਖਿਆ ਪ੍ਰਣਾਲੀ ਵਿੱਚ ਆਧੁਨਿਕ ਢੰਗਾਂ ਅਤੇ ਟੈਕਨੋਲੋਜੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਡਿਜੀਟਲ ਸਿੱਖਿਆਵਾਂ ਨੂੰ ਵੱਧ ਦੇਣ ਲਈ ਵਿਦਿਆਰਥੀ ਸੰਸਾਰਕ ਮਾਪਦੰਡਾਂ 'ਤੇ ਖਰੇ ਉਤਰ ਸਕਣ ਇਸ ਤਰ੍ਹਾਂ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਦੀ ਸਮੁੱਚੀ ਵਿਕਸਿਤ ਲਈ ਸੰਕਲਪਿਤ ਹੈ